ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਔਰ ਮੈਂ ਹੁਸ਼ਿਆਰਪੁਰ ਤੋਂ ਆਈ ਹਾਂ ਅਤੇ ਮੈਨੂੰ ਇੱਥੇ ਕੋਈ ਡੈਅਰੀ ਦੁੱਧ ਵਧੀਆ ਡੈਅਰੀ ਦੱਸੋ ਜਿਹਦੇ 'ਚ ਦੁੱਧ ਦਹੀਂ ਸਹੀ ਢੰਗ ਨਾਲ ਮਿਲਦਾ ਹੋਵੇ ਅਤੇ ਅਤੇ ਵਧੀਆ ਕੁਆਲਟੀ ਦਾ ਮਿਲ ਜਾਂਦਾ ਠੀਕ ਆ ਓਕੇ ਜੀ